ਭੰਗੜਾ ਸਾਡੇ ਪੰਜਾਬੀਆਂ ਦਾ ਮਨ ਪਸੰਦੀਦਾ ਲੋਕ ਨਾਚ ਹੈ ਇਹ ਸਾਡੇ ਪੰਜਾਬੀ ਜਸ਼ਨਾਂ ਵਿੱਚ ਇੱਕ ਖਾਸ ਯੋਗਦਾਨ ਪਾਉਣ ਵਾਲਾ ਅਤੇ ਸਾਡੀਆਂ ਖੁਸ਼ੀਆਂ ਨੂੰ ਹੋਰ ਵਧਾਉਣ ਵਾਲਾ ਨਾਚ ਹੈ ਭੰਗੜੇ ਦੇ ਕੁਝ ਸਟੈਪ ਮੈਂ ਜਾਣਦੀ ਹਾਂ ਜਿਵੇਂ ਧਮਾਲ ਜੁਗਨੀ ਝੂਮਰ ਥਾਪੀ ਲੁੱਡੀ ਮਿਰਜ਼ਾ ਛਾਟਾ ਆਦਿ ਇਹ ਮੈਂ ਸਟੈਪ ਕੀਤੇ ਵੀ ਹੋਏ ਹਨ ਅਤੇ ਦੇਖੇ ਵੀ ਹੋਏ ਹਨ ਇਸ ਨਾਲ ਭੰਗੜੇ ਵਿੱਚ ਚਾਰ ਚੰਨ ਲੱਗਦੇ ਹਨ ਅਤੇ ਵੇਖਣ ਵਾਲੇ ਨੂੰ ਵੀ ਮਜ਼ਾ ਆ ਜਾਂਦਾ ਹੈ